ਹਾਂਜੀ ਹ ਹਾਂਜੀ ਠੀਕ ਜੀ ਹਾਂਜੀ ਮੈਡਮ ਜੀ ਅ ਸਕੂਲ ਦਾ ਟਰਿੱਪ ਜਾ ਰਿਹਾ ਜੀ ਅੰਮ੍ਰਿਤਸਰ ਹਾਂਜੀ ਉਨ੍ਹਾਂ ਦੇ ਲਈ ਤੁਸੀਂ ਹਜ਼ਾਰ ਰੁਪਏ ਜਮਾਂ ਕਰਵਾ ਦਿਓ ਜੀ ਅਤੇ ਆਲਮ ਦੇ ਫੋਨ ਪੇ 'ਤੇ ਭੇਜ ਦਿਓ ਹਾਂ ਜਦੋਂ ਸਵੇਰੇ ਨਿਕਲ ਜਾਈਏ ਅੰਮ੍ਰਿਤਸਰ ਘੁੰਮਾ ਦੇਈਏ ਜੀ ਪੰਜ ਪੰਜ ਚੀਜ਼ਾਂ ਤੋਂ ਘੁਮਾਉਣ ਵਾਸਤੇ ਹੁਣ ਪੰਜ ਛੇ ਜਗ੍ਹਾ ਤੁਹਾਨੂੰ ਘੁੰਮਾ ਦੇਈਏ ਜੀ ਬਾਕੀ ਸਾਰੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਆਹੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕ